ਖੂਹ ਤੋਂ ਪਾਣੀ ਕੱਢਣ ਦਾ ਪਹਿਲੇ ਸਮੇਂ ਵਿੱਚ ਬਹੁਤ ਹੁੰਦਾ ਸੀ ਖੂਹ ਤੋਂ ਪਾਣੀ ਪਹਿਲੇ ਸਮੇਂ ਵਿੱਚ ਖੂਹ ਤੋਂ ਪਾਣੀ ਬਾਲਟੀਆਂ ਨਾਲ ਕੱਢਿਆਂ ਜਾਂਦਾ ਸੀ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਉਵੇਂ ਉਵੇਂ ਫਿਰ ਇੱਕ ਸਮਾਂ ਆਇਆ ਏ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਉਵੇਂ ਉਵੇਂ ਪਾ ਖੂਹ ਵਾਲੇ ਪਾਣੀ ਵਿੱਚ ਵੀ ਵਰਤ ਖੂਹ ਵਾਲੇ ਪਾਣੀ ਦੀ ਵਰਤੋਂ ਵੀ ਬਹੁਤ ਫਰਕ ਪੈ ਗਿਆ ਫਿਰ ਸਮਾਂ ਆਇਆ ਕਿ ਪਾਣੀ ਦੀ ਟੈ ਖੂਹ ਵਿੱਚੋਂ ਪਾਣੀ ਦੀ ਵਿੱਚ ਇੱਕ ਫੀਰਕੀ ਡੀ ਪਾਈ ਗਈ ਜਿਸ ਵਿੱਚ ਪਾਣੀ ਕੱਢਣਾ ਬਹੁਤ ਆਸਾਨ ਹੋ ਗਿਆ ਅਤੇ ਉਹ ਖੇਤਾਂ ਵਿੱਚ ਪਾਣੀ ਜਾਣ ਲੱਗ ਪਿਆ ਹੌਲੀ ਹੌਲੀ ਪਾਣੀ ਹੌਲੀ ਹੌਲੀ ਘਰਾਂ ਵਿ ਹੌਲੀ ਹੌਲੀ ਮੋਟਰਾਂ ਤੇ ਵੱਡੀਆਂ ਮੋਟਰ ਲਾ ਦਿੱਤੀਆਂ ਗਈਆਂ ਜਿੱਥੋਂ ਪਾਣੀ ਬਹੁਤ ਜਲਦੀ ਆਉਣ ਦੀ ਸੰਭਾਵਨਾ ਹੋ ਜਾਵੇ ਪਾਣੀ ਜਿੱਦਾਂ ਜਿੱਦਾਂ ਆਈ ਗਿਆ ਉਵੇਂ ਉਵੇਂ ਖੇਤਾਂ ਵਿੱਚ ਵਿਸਰਜਣ ਹੁੰਦਾ ਗਿਆ ਪਾਣੀ ਜਦੋਂ ਖੇਤਾਂ ਵਿੱਚ ਪਾਣੀ ਹੁੰਦਾ ਤਾਂ